ਮੱਛੀਆਂ ਫੜਨ ਨਾਲ ਵਾਤਾਵਰਨ ਅਤੇ ਪਾਣੀ ਦਾ ਬਹੁਤ ਹੀ ਪ੍ਰਦੂਸ਼ਣ ਫੈਲ ਰਿਹਾ ਹੈ ਜਿਵੇਂ ਕਿ ਲੋਕ ਮੱਛੀਆਂ ਫੜਨ ਲਈ ਜੋ ਉਹ ਕਾਂਟਾ ਜਿਹਾ ਫੇਕ ਦੇ ਆ ਵਿੱਚ ਉਹਦੇ ਅੱਗੇ ਕੁਛ ਕੈਮੀਕਲ ਲਗਾਇਆ ਹੁੰਦਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ ਅਤੇ ਪਾਣੀ ਦੇ ਉਹ ਪਾਣੀ ਲੋਕਾਂ ਦੇ ਘਰਾਂ ਤੱਕ ਜਾਂ ਖੇਤਾਂ ਤੱਕ ਪਹੁੰਚਦਾ ਹੈ ਉਹ ਦੂਸ਼ਿਤ ਹੋ ਜਾਂਦਾ ਹੈ ਅਤੇ ਜਿਸ ਨਾਲ ਕਈ ਸਾਰੀਆਂ ਬਿਮਾਰੀਆਂ ਵੀ ਫੈਲਦੀਆਂ ਹਨ ਜਿਸ ਕਾਰਨ ਸਾਨੂੰ ਮੱਛੀ ਫੜਨ ਤੋਂ ਰੋਕਣਾ ਚਾਹੀਦਾ ਹੈ ਅਤੇ ਵਾਤਾਵਰਨ ਸੰਭਾਲ ਵੀ ਹੋ ਸਕਦੀ ਹੈ ਇਸ ਦੇ ਨਾਲ